ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਤੁਸੀਂ ਫਸਟ ਵਾਰ ਆ ਰਹੇ ਹੋ ਹਾਂਜੀ ਕੋਈ ਗੱਲ ਨਹੀਂ ਤੁਸੀਂ ਕੱਲ੍ਹ ਦੀ ਅਪੋਆਇੰਟਮੈਂਟ ਅਪੋਆਇੰਟਮੈਂਟ ਰੱਖ ਲਓ ਅਤੇ ਤੁਸੀਂ ਕੱਲ੍ਹ ਨੂੰ ਆ ਜਾਇਓ ਹਾਂਜੀ ਕੱਲ੍ਹ ਨੂੰ ਤੁਸੀਂ ਦਸ ਵਜੇ ਸਵੇਰੇ ਆ ਜਾਇਓ ਅਤੇ ਆਪਣਾ ਡਾਟਾ ਦੱਸ ਦਿਓ ਹਾਂਜੀ ਓਕੇ ਜੀ ਹਾਂਜੀ ਹਾਂਜੀ ਹਾਂਜੀ ਕੋਈ ਗੱਲ ਨਹੀਂ ਤੁਸੀਂ ਉਹਨਾਂ ਦਾ ਨਾਮ ਵੀ ਦੱਸ ਦਿਓ ਅਤੇ ਤੁਸੀਂ ਦੇਖ ਲਿਓ ਫੇਰ ਕੱਲ੍ਹ ਨੂੰ ਆ ਜਾਇਓ ਹਾਂਜੀ ਦੱਸ ਦਿਓ ਨਾਮ ਹਾਂਜੀ ਠੀਕ ਹੈ ਜੀ ਠੀਕ ਹੈ ਉਹਨਾਂ ਦੀ ਪਰਚੀ ਵੀ ਕੱਟ ਦਈਏ ਉਹਨਾਂ ਦੀ ਪਰਚੀ ਵੀ ਕੱਟ ਤੀ ਇੱਕ ਤੁਸੀਂ ਕੱਲ੍ਹ ਨੂੰ ਆ ਜਾਇਓ ਨਹੀਂ ਡਾਕਟਰ ਤਾਂ ਆਉਣਗੇ ਅਤੇ ਤੁਸੀਂ ਦੇਖ ਲਿਓ ਡਾਕਟਰ ਸਵੇਰੇ ਨੌ ਵਜੇ ਬੈਠਣਗੇ ਜੀ ਹਾਂਜੀ ਕੋਈ ਗੱਲ ਨਹੀਂ ਫਿਰ ਤੁਸੀਂ ਪਰਸੋਂ ਨੂੰ ਆ ਜਾਇਓ ਪਰਸੋਂ ਸਵੇਰੇ ਡਾਕਟਰ ਦਸ ਵਜੇ ਬੈਠਣਗੇ ਫਿਰ ਹਾਂਜੀ